ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਅਤੇ ਮੈਂ ਸੋਚਦਾ ਹਾਂ ਕਿ ਪੰਜਾਬੀ ਅਤੇ ਹਿੰਦੀ ਆਪਣੇ ਆਪਣੇ ਛੇਤਰ ਵਿੱਚ ਬਹੁਤ ਅਲੱਗ ਅਲੱਗ ਭਾਸ਼ਾਵਾਂ ਹਨ ਪੰਜਾਬੀ ਭਾਸ਼ਾ ਜੋ ਕਿ ਪੰਜਾਬ ਦੀ ਮਾਂ ਭਾਸ਼ਾ ਹੈ ਇਹ ਹਰ ਇੱਕ ਪੰਜਾਬ ਦੇ ਅਲੱਗ ਅਲੱਗ ਹਿੱਸੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਜਦ ਕਿ ਹਿੰਦੀ ਸਾਰੇ ਰਾਸ਼ਟਰ ਵਿੱਚ ਇੱਕ ਹੀ ਤਰੀਕੇ ਨਾਲ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਜੋ ਕਿ ਪੰਜਾਬ ਵਿੱਚ ਹੀ ਬਣੀ ਹੈ ਉਹ ਬਹੁਤ ਲੋਕ ਪੰਜਾਬ ਦੇ ਉਹਨੂੰ ਹੀ ਵਰਦੇ ਹਨ ਹਾਲਾਂਕਿ ਹਿੰਦੀ ਹਾਲਾਂਕਿ ਸਾਡੀ ਰਾਸ਼ਟਰ ਭਾਸ਼ਾ ਵੀ ਹੋਏ ਲੇਕਿਨ ਪੰਜਾਬ 'ਚ ਲੋਕ ਪੰਜਾਬੀ ਹੀ ਬੋਲਦੇ ਹਨ ਲੇਕਿਨ ਪੰਜਾਬ ਤੋਂ ਇਲਾਵਾ ਬਹੁਤ ਘੱਟ ਲੋਕ ਹਨ ਜੋ ਪੰਜਾਬੀ ਬੋਲਦੇ ਹਨ ਲੇਕਿਨ ਹਿੰਦੀ ਭਾਸ਼ਾ ਨੂੰ ਰਾਸ਼ਟਰ ਵਿੱਚ ਬਹੁਤ ਜ਼ਿਆਦਾ ਬੋਲਿਆ ਜਾਂਦਾ ਹੈ ਇਸ ਕਰਕੇ ਹਿੰਦੀ ਰਾਸ਼ਟਰੀ ਭਾਸ਼ਾ ਹੀ ਹੋਣੀ ਚਾਹੀਦੀ ਹੈ ਲੇਕਿਨ ਪੰਜਾਬ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ